ਮੇਰੇ ਬਹੁਤ ਸਾਰੇ ਦੋਸਤ ਅਜਿਹੇ ਹਨ ਜਿਹਨਾਂ ਨੇ ਕਾਲਜ ਦੀ ਡਿਗਰੀ ਪ੍ਰਾਪਤ ਕਰ ਰੱਖੀ ਹੈ ਅਤੇ ਮੇਰੇ ਕਈ ਦੋਸਤ ਹਾਲੇ ਵੀ ਆਪਣੀ ਡਿਗਰੀ ਪ੍ਰਾਪਤ ਕਰਨ ਵਿਚ ਲੱਗੇ ਹੋਏ ਹਨ ਮੇਰੇ ਦੋਸਤ ਜਸਪ੍ਰੀਤ ਜਿਹਨੇ ਕਿ ਆਪਣੀ ਡਬਲ ਐਮ ਏ ਦੀ ਅੰਗਰੇਜ਼ੀ ਦੀ ਡਿਗਰੀ ਖਾਲਸਾ ਕਾਲਜ ਪਟਿਆਲਾ ਤੋਂ ਪ੍ਰਾਪਤ ਕੀਤੀ ਹੈ ਉਹ ਇਹ ਡਿਗਰੀ ਪ੍ਰਾਪਤ ਕਰਕੇ ਆਪਣੀ ਅੱਗੇ ਟੈਸਟ ਦੀ ਤਿਆਰੀ ਕਰਨ ਲੱਗ ਪਿਆ ਅਤੇ ਉਸ ਨੂੰ ਆਪਣੇ ਇਹ ਟੈਸਟ ਪਾਸ ਕਰਨ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਹ ਅੰਤ ਤੱਕ ਅਤੇ ਮਿਹਨਤੀ ਹੋਣ ਕਰਕੇ ਇਹਨਾਂ ਸਭ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੋਇਆ ਟੈਸਟ ਪਾਸ ਕਰਕੇ ਅੱਜ ਅੰਗਰੇਜ਼ੀ ਦਾ ਸਰਕਾਰੀ ਸਕੂਲ ਵਿੱਚ ਅਧਿਆਪਕ ਲੱਗਿਆ ਹੋਇਆ ਹੈ ਭਾਵੇਂ ਉਸਨੇ ਇਹ ਸਾਰੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰੰਤੂ ਉਹ ਇਹਨਾਂ ਸਭ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੋਇਆ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਗਿਆ ਅੱਜ ਉਹ ਆਪਣੇ ਜੀਵਨ ਵਿੱਚ ਸਫਲ ਹੋ ਚੁੱਕਿਆ ਹੈ ਉਸ ਨੇ ਆਪਣੀ ਡਿਗਰੀ ਪ੍ਰਾਪਤ ਕਰਕੇ ਬਹੁਤ ਵਧੀਆ ਕੀਤਾ ਅੱਜ ਉਹ ਇੱਕ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ ਹੈ ਉਸ ਦਾ ਸਮਾਜ ਵਿੱਚ ਇੱਕ ਰੁਤਬਾ ਹੈ ਉਸਨੂੰ ਸਾਰੇ ਮਾਸਟਰ ਜੀ ਮਾਸਟਰ ਜੀ ਕਹਿ ਕੇ ਬੁਲਾਉਂਦੇ ਹਨ ਉਸ ਦੇ ਮਾਤਾ ਪਿਤਾ ਵੀ ਜਦ ਉਸਦੀਆਂ ਤਰੀਫਾਂ ਸੁਣਦੇ ਹਨ ਤਾਂ ਬਹੁਤ ਖੁਸ਼ ਹੁੰਦੇ ਹਨ ਕਿ ਉਹਨਾਂ ਦਾ ਪੁੱਤ ਲਾਇਕ ਨਿਕਲਿਆ ਉਸਦੇ ਮਾਤਾ ਪਿਤਾ ਉਸ ਤੋਂ ਬਹੁਤ ਹੀ ਖੁਸ਼ ਹਨ ਅਤੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡਾ ਦੋਸਤ ਸਰਕਾਰੀ ਨੌਕਰੀ 'ਤੇ ਲੱਗ ਗਿਆ ਉਸਦੇ ਕਾਰਨ ਸਮਾਜ ਵਿੱਚ ਲੋਕ ਸਾਡੀ ਵੀ ਇੱਜ਼ਤ ਕਰਦੇ ਹਨ ਜਦ ਅਸੀਂ ਉਸ ਨਾਲ ਜਾਂਦੇ ਹਾਂ ਤਾਂ ਸਾਨੂੰ ਉਸ ਨੂੰ ਦੇਖ ਕੇ ਬਹੁਤ ਮਾਣ ਗਰਵ ਮਹਿਸੂਸ ਹੁੰਦਾ ਹੈ ਕਿ ਸਾਡਾ ਦੋਸਤ ਇੱਕ ਸਰਕਾਰੀ ਨੌਕਰੀ 'ਤੇ ਲੱਗ ਚੁੱਕਿਆ ਹੈ